ਦੇਖੋ ਜੀ ਅਸੀਂ ਬਾਗਵਾਨੀ ਕਰੀ ਦੀ ਆ ਠੀਕ ਹੈ ਜੀ ਇਹਦੇ ਵਿੱਚ ਮੰਨ ਲਓ ਵੀ ਜਿਹੜੇ ਸੰਦ ਵਰਤੇ ਜਾਂਦੇ ਆ ਰੰਬੀ ਹੋ ਗਿਆ ਮਤਲਬ ਗੋਡੀ ਕਰਨ ਨੂੰ ਠੀਕ ਹੈ ਜੀ ਅਤੇ ਬਾਕੀ ਇਹ ਕਹੀ ਵੀ ਵਰਤੀ ਹੁੰਦੀ ਆ ਠੀਕ ਹੈ ਵੱਟਾਂ ਵਗੈਰਾ ਪਾਉਣ ਨੂੰ ਅਤੇ ਬਾਕੀ ਹੋਰ ਰੰਭੀ ਹੋ ਗਏ ਹਲ ਹੋਏ ਹੱਲ ਵਗੈਰਾ ਵਾਹੀ ਕਰਨ ਨੂੰ ਵਰਤੇ ਜਾਂਦੇ ਆ ਸੁਹਾਗੀ ਹੋ ਗਈ ਜਾਨੀ ਕਿ ਸੁਹਾਗਾ ਵਾਹ ਕੇ ਉਹਨੂੰ ਜਾਨੀ ਕਿ ਸੁਹਾਗਾ ਦਿੱਤਾ ਜਾਂਦਾ ਠੀਕ ਹੈ ਜੀ ਉੱਦੋਂ ਬਾਅਦ ਕੀ ਹੈਗਾ ਜੀ ਮਤਲਬ ਕਿ ਉਹ ਚੰਗੀ ਤਰ੍ਹਾਂ ਉਹ ਕੀਤਾ ਜਾਂਦਾ ਹੈਗਾ ਮੁੜ ਕੇ ਫਿਰ ਫਿਰ ਮਤਲਬ ਜੇ ਮੀਂਹ ਮੂਹ ਪੈ ਬਾਰਿਸ਼ ਪੈਣ ਲੱਗ ਜਾਂਦੀ ਉਹਦੇ ਵਿੱਚ ਮਤਲਬ ਕਿ ਨਾ ਵੀ ਉਹਨੂੰ ਕੀੜਾ ਪੈ ਜਾਂਦਾ ਹੈਗਾ ਅਤੇ ਉਹ ਸਪਰੇ ਵਾਲਾ ਪੰਪ ਵਗੈਰਾ ਵੀ ਹੈਗਾ ਮਤਲਬ ਅਸੀਂ ਉਹਦੇ ਨਾਲ ਸਪਰੇ ਕਰੀ ਦੀ ਆ ਠੀਕ ਹੈ ਜੀ ਅਤੇ ਜਾਨੀ ਕਿ ਇਹ ਤਾਂ ਵਧੀਆ ਹੁੰਦਾ ਜੀ